ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਇੱਕ ਬੇਨਤੀ ਲੈ ਕੇ ਆਈ ਸੀ ਕਿ ਮੈਂ ਪੰਜਵੀਂ ਕਲਾਸ ਦੇ ਨਾ ਲੈਸਨ ਪਲੈਨ ਬਣਾਏ ਸੀ ਤਿੰਨ ਪਾਠਾਂ ਦੇ ਠੀਕ ਹੈ ਅਤੇ ਜੇ ਤੁਸੀਂ ਆਗਿਆ ਦਿਓ ਤਾਂ ਮੈਂ ਉਹ ਤਿੰਨੋਂ ਪਾਠਾਂ ਦੇ ਜਿਹੜਾ ਕੰਮ ਹੈ ਬੱਚਿਆਂ ਨੂੰ ਕਰਵਾ ਦੇਵਾਂ ਨਹੀਂ ਨਹੀਂ ਸਰ ਆਪਾਂ ਨੇ ਸਾਰਾ ਕੰਮ ਇਕੱਠਾ ਨਹੀਂ ਨਾ ਕਰਵਾਉਣਾ ਆਪਾਂ ਪਹਿਲਾਂ ਸੌਖਾ ਸੌਖਾ ਕੰਮ ਜਿਵੇਂ ਆਪਾਂ ਸ਼ਬਦ ਅਰਥ ਕਰਵਾ ਦਿੱਤੇ ਪਹਿਲਾਂ ਅਭਿਆਸ ਕਰਵਾ ਦਿੱਤੀ ਖਾਲੀ ਥਾਵਾਂ ਹੁੰਦੀਆਂ ਆ ਸਹੀ ਗਲਤ ਹੁੰਦੇ ਆ ਇਹ ਛੋਟਾ ਛੋਟਾ ਕੰਮ ਆਪਾਂ ਕਰਵਾ ਦਿੰਦੇ ਹਾਂ ਠੀਕ ਹੈ ਕਿਉਂਕਿ ਪੇਪਰ ਬਹੁਤ ਨੇੜੇ ਆ ਰਹੇ ਹਾਂ ਜੇ ਕੰਮ ਬੱਚਿਆਂ ਨੇ ਕੀਤਾ ਹੋਵੇਗਾ ਅਤੇ ਹੌਲੀ ਹੌਲੀ ਉਹ ਯਾਦ ਕਰਦੇ ਰਹਿਣਗੇ ਅੱਛਾ ਸਰ ਠੀਕ ਹੈ ਸਰ ਆਪਾਂ ਕਰਵਾ ਦਿੰਦੇ ਹਾਂ ਕੰਮ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਰ